ਸਕੂਲਾਂ ਵਿੱਚ ਰਿਟਰਨਾਂ ਅਤੇ ਲੋਨ ਦੀ ਹਰ ਇੱਕ ਹਰ ਇੱਕ ਤਰ੍ਹਾਂ ਦਾ ਦੱਸਣਾ ਚਾਹੀਦਾ ਹੈ ਸਕੂਲਾਂ ਵਿੱਚ ਪੜ੍ਹਾਉਣਾ ਚਾਹੀਦਾ ਹੈ ਜਿਸ ਦੇ ਨਾਲ ਸਾਨੂੰ ਜੋ ਕਿ ਅੱਗੇ ਵਧਣ 'ਚ ਪਤਾ ਹੋਣਾ ਚਾਹੀਦਾ ਹੈ ਜਿਵੇਂ ਕਿ ਲੋਨ ਲੂਨ ਦੀ ਲੋੜ ਪੈਂਦੀ ਹੀ ਰਹਿੰਦੀ ਹੈ ਪਈ ਹੀ ਰਹਿੰਦੀ ਹੈ ਇਸ ਕਰਕੇ ਅਣਜਾਣ ਬੰਦੇ ਨੂੰ ਬੈਂਕ ਵਾਲੇ ਘੱਟ ਵੱਧ ਪੈਸੇ ਲੈ ਲੈ ਕੇ ਵੱਧ ਪੈਸੇ ਲੈ ਜਾਂਦੇ ਹਨ ਠੱਗ ਲੈਂਦੇ ਹਨ ਜੋ ਕਿ ਸਾਨੂੰ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਹੈ ਉਸ ਦੇ ਵਿੱਚ ਜੋ ਤਰਜੀਹ ਲਾਈਫ ਨੂੰ ਲਾਈਫ ਵਿੱਚ ਅੱਗੇ ਵਧਣ ਵਾਸਤੇ ਸਾਨੂੰ ਕੁਛ ਵੀ ਨਹੀਂ ਇਹੋ ਜਿਹਾ ਸਿਖਾਇਆ ਜਾਂਦਾ ਸਕੂਲੇ ਨਹੀਂ ਪੜ੍ਹਾਇਆ ਜਾਂਦਾ ਇਸ ਕਰਕੇ ਇਹ ਸਕੂਲਾਂ ਦੇ ਵਿੱਚ ਜ਼ਰੂਰੀ ਹੋਣਾ ਚਾਹੀਦਾ ਹੈ ਕਿ ਸਾਨੂੰ ਬੈਂਕਾਂ ਬਾਰੇ ਰਿਟਰਨਾਂ ਬਾਰੇ ਅਤੇ ਲੋਨ ਵਗੈਰਾ ਹਰ ਇੱਕ ਚੀਜ਼ ਬਾਰੇ ਦੱਸਿਆ ਜਾਵੇ ਪੜ੍ਹਾਇਆ ਜਾਵੇ ਜਿਹਦੇ ਨਾਲ ਅਸੀਂ ਆਪਣੀ ਲਾਈਫ ਦੇ ਵਿੱਚ ਅੱਗੇ ਵਧਣ ਤੋਂ ਬਿਲਕੁਲ ਹੀ ਅਸਫਲਤਾ ਵੱਲ ਨਾ ਹੋਈਏ ਆਪਣੇ ਲਾਈਫ ਨੂੰ ਅੱਗੇ ਵਧੀਏ ਸਫਲ ਨਾਲ ਸਫਲਤਾ ਦੇ ਨਾਲ ਅੱਗੇ ਵਧੀਏ